ਹੈਲੋ ਹਾਂਜੀ ਹਾਂਜੀ ਹਾਂਜੀ ਬਸੰਤ ਕੰਟੀਨ ਤੋਂ ਬੋਲ ਰਿਹਾ ਜੀ ਹਾਂ ਹਾਂਜੀ ਹਾਂਜੀ ਦੱਸੋ ਅੱਛਾ ਜੀ ਮੈਮ ਲੰਚ ਵਿੱਚ ਅਸੀਂ ਦਿੰਦੇ ਹਾਂ ਜੀ ਮਤਲਬ ਇਹ ਇੱਕ ਦਾਲ ਹੋ ਗਈ ਇੱਕ ਸਬਜ਼ੀ ਹਾਂਜੀ ਹਾਂਜੀ ਅਤੇ ਮਿਕਸ ਵੈੱਜ ਜੀ ਅਤੇ ਨਾਲ ਚਾਵਲ ਅਤੇ ਨਾਲ ਜਲੇਬੀ ਮਤਲਬ ਪਲੇਟ ਹਾਂਜੀ ਲੰਚ ਹਾਂਜੀ ਸਾਡੀ ਪਰ ਪਲੇਟ ਕੋਸਟ ਮੈਮ ਟੂ ਹੰਡਰਡ ਰੁਪੀਸ ਹੈ ਪਰ ਪਲੇਟ ਅਤੇ ਬਾਕੀ ਤੁਹਾਨੂੰ ਰਹੀ ਬਾਤ ਕੁਆਲਿਟੀ ਦੀ ਤੁਹਾਨੂੰ ਕੁਆਲਿਟੀ ਇਕਦਮ ਵਧੀਆ ਮਿਲੂਗੀ ਤੁਹਾਨੂੰ ਕੋਈ ਕੰਪਲੇਂਟ ਨਹੀਂ ਆਉਗੀ ਵੈਸੇ ਅਸੀਂ ਹੋਰ ਜਗ੍ਹਾ ਵੀ ਮਤਲਬ ਆਪਣਾ ਮਤਲਬ ਮਟੀਰੀਅਲ ਦਿੰਦੇ ਹਾਂ ਤਾਂ ਇੱਦਾਂ ਦੀ ਸਾਡੀ ਕੋਈ ਕੰਪਲੇਂਟ ਨਹੀਂ ਹੈ ਜੀ ਅਸੀਂ ਚੀਜ਼ ਵਧੀਆ ਹੀ ਦਿੰਦੇ ਅੱਛਾ ਦੋ ਸੌ ਗੈਸਟ ਹੈ ਜੀ ਕੋਈ ਨੀ ਮੈਮ ਤੁਹਾਡਾ ਹੋ ਮਤਲਬ ਹਾਂਜੀ ਹਾਂਜੀ ਹੋ ਜਾਏਗਾ ਪਰਸੋਂ ਮਤਲਬ ਕਦੋਂ ਤੀਕਰ ਮਤਲਬ ਤੁਹਾਨੂੰ ਚਾਹੀਦਾ ਜੀ ਇਹ ਆਪਣਾ ਨਹੀਂ ਨਹੀਂ ਮੈਮ ਤੁਹਾਨੂੰ ਕੋਈ ਇੱਦਾਂ ਦੀ ਕੰਪਲੇਂਟ ਨਹੀਂ ਮਿਲੂਗੀ ਬਸ ਤੁਸੀਂ ਮੈਨੂੰ ਆਪਣਾ ਐਡਰੈਸ ਦੇ ਦਿਓ ਜੋ ਵੀ ਹੈ ਬਾਕੀ ਤੁਹਾਡੇ ਕੋਲ ਅਸੀਂ ਆਪਣਾ ਜੋ ਵੀ ਹੈ ਡਿਲੀਵਰੀ ਬੋਆਏ ਅ ਆਜੂਗਾ ਉਹ ਤੁਹਾਨੂੰ ਆਪਣੇ ਆਪ ਸਰਵ ਜੋ ਵੀ ਹੈ ਉਹ ਦੇ ਕੇ ਚਲ ਜਾਊਗਾ ਜੀ ਪਰਸੋਂ ਤੱਕ ਹਾਂਜੀ ਮੈਮ ਕੋਈ ਨਹੀਂ ਤੁਸੀਂ ਐਡਰੈਸ ਸੈਂਡ ਕਰ ਦਿਓ ਬਾਕੀ ਮੈਂ ਪਰਸੋਂ ਤੱਕ ਤੁਹਾਡਾ ਮੈਂ ਹਾਂਜੀ ਹਾਂਜੀ ਸਮਾਨ ਤਾ ਲੰਚ ਪੁੱਜ ਜੂਗਾ ਜੀ ਠੀ ਠੀਕ ਓਕੇ ਮੈਮ ਠੀਕ ਹੈ ਥੈਂਕ ਯੂ